ਮੈਂ ਨੇੜਲਿਆਂ ਕਸਬਿਆਂ ਪਿੰਡਾਂ ਦਾ ਦੌਰਾ ਕਰਦੀ ਹਾਂ ਉਹਨਾਂ ਦੇ ਉਦੇਸ਼ਾਂ ਲਈ ਮੈਂ ਸਹੂਲਤਾਂ ਦੇਖਦੀ ਹਾਂ ਜਿਵੇਂ ਕਿ ਸਕੂਲਾਂ ਹਸਪਤਾਲਾਂ ਸੜਕਾਂ ਪਾਰਕਾਂ ਰੁਜ਼ਗਾਰ ਖੇਤੀਬਾੜੀ ਪਸ਼ੂ ਪਾਲਣ ਕਾਰੋਬਾਰ ਕਿਸ ਤਰ੍ਹਾਂ ਹੋ ਰਹੇ ਹਨ ਜਿਵੇਂ ਕਿ ਮੈਂ ਦੇਖ ਰਹੀ ਹਾਂ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਹਨ ਉਹਨਾਂ ਦੀ ਸਾਰੀ ਜ਼ਿੰਮੇਵਾਰੀਆਂ ਪੂਰੀਆਂ ਹੋ ਰਹੀ ਹਨ ਉਹਨਾਂ ਦੀ ਪੜ੍ਹਾਈ ਚੰਗੀ ਤਰ੍ਹਾਂ ਹੋ ਰਹੀ ਹੈ ਉਹਨਾਂ ਨੂੰ ਕੋਈ ਜਾਣ ਦੇ ਵਿੱਚ ਦਿੱਕਤ ਨਹੀਂ ਹੋ ਰਹੀ ਹੈ ਉੱਦਾਂ ਹੀ ਮੈਂ ਹਸਪਤਾਲ ਦੇ ਵਿੱਚ ਦੇਖਦੀ ਹਾਂ ਜਿਵੇਂ ਬਿਮਾਰ ਬੱਚੇ ਨੂੰ ਸਹੀ ਸਮੇਂ ਦੇ ਵਿੱਚ ਦਵਾਈ ਮਿਲ ਰਹੀ ਹੈ ਉਹਨਾਂ ਦਾ ਇਲਾਜ ਵਧੀਆ ਤਰ੍ਹਾਂ ਹੋ ਰਿਹਾ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ ਆਉਣ ਜਾਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਉਹਨਾਂ ਨੂੰ ਮੈਡੀਸਿਨ ਸਹੀ ਸਮੇਂ 'ਤੇ ਮਿਲ ਰਹੀ ਹੈ ਉਸ ਤੋਂ ਬਾਅਦ ਸੜਕਾਂ ਸੜਕਾਂ ਦੀ ਸਹੂਲਤਾਂ ਦੇ ਲਈ ਬਹੁਤ ਸਾਰੀ ਉਪਲੱਬਧੀਆਂ ਹੋਣੀ ਚਾਹੀਦੀਆਂ ਹਨ ਪਾਰਕ ਦੇ ਵਿੱਚ ਵੀ ਬਹੁਤ ਸਾਰਾ ਖੁੱਲ੍ਹਾ ਉਹ ਹੋਣਾ ਮੈਦਾਨ ਹੋਣਾ ਚਾਹੀਦਾ ਜੇ ਲੋਕ ਨੂੰ ਹਵਾ ਵ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ ਉਵੇਂ ਹੀ ਰੁਜ਼ਗਾਰ ਰੁਜ਼ਗਾਰ ਦੇ ਵਿੱਚ ਅੱਜ ਕੱਲ੍ਹ ਲੋਕ ਦੇ ਵਿੱਚ ਰੁਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜੇ ਰੁਜ਼ਗਾਰ ਨਹੀਂ ਹੋਵੇਗਾ ਤਾਂ ਕੰਮ ਕਰਨਾ ਬਹੁਤ ਔਖਾ ਹੈ ਅਤੇ ਘਰ ਦਾ ਖਰਚਾ ਚਲਾਉਣਾ ਵੀ ਬਹੁਤ ਮੁਸ਼ਕਿਲ ਹੈ ਉਸ ਤੋਂ ਬਾਅਦ ਖੇਤੀਬਾੜੀ ਖੇਤੀਬਾੜੀ ਅੱਜ ਕੱਲ੍ਹ ਬਹੁਤ ਜ਼ਿਆਦਾ ਜਰੂਰੀ ਹੈ ਜੇ ਖੇਤੀਬਾੜੀ ਨਾ ਹੋਏ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਪੈਦਾ ਹੋ ਸਕਦੀ ਹੈ ਹੋਰ ਲ ਲੋਕਾਂ ਦੀ ਸਹੂਲਤਾਂ ਦੀ ਪਸ਼ੂ ਪਾਲਣ ਵੀ ਹੈ ਬਹੁਤ ਲੋਕ ਪਸ਼ੂ ਪਾਲਣ ਵੀ ਕਰਦੇ ਹਨ ਜਿਵੇਂ ਕਿ ਉਹਨਾਂ ਦਾ ਕਾਰੋਬਾਰ ਜਿਸ ਨਾਲ ਬਹੁਤ ਜ਼ਿਆਦਾ ਵਧੀਆ ਚੱਲਦਾ ਹੈ ਫਿਰ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈ ਅਤੇ ਜਿਸ ਨਾਲ ਉਹਨਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਵਧੀਆ ਚੱਲਦਾ ਹੈ ਇਸ ਤਰ੍ਹਾਂ ਮੈਂ ਬਹੁਤ ਸਾਰੀ ਸਹੂਲਤਾਂ ਅਤੇ ਕਸਬਿਆਂ ਦੇ ਵਿੱਚ ਬਹੁਤ ਵਾਰੀ ਜਾਂਦੀ ਹਾਂ ਇੱਕ ਵਾਰ ਮੈਂ ਇੱਕ ਪਿੰਡ ਵਿੱਚ ਗਈ ਅਤੇ ਮੈਂ ਉੱਥੇ ਦੇਖਿਆ ਬੱਚੇ ਐਵੇਂ ਹੀ ਖੇਡ ਰਹੇ ਸੀ ਮੈਂ ਉਹਨਾਂ ਤੋਂ ਪੁੱਛਿਆ ਵੀ ਬੇਟਾ ਤੁਸੀਂ ਸਕੂਲ ਕਿਉਂ ਨਹੀਂ ਜਾ ਰਹੇ ਹੋ ਫਿਰ ਉਹਨਾਂ ਨੇ ਕਿਹਾ ਸਕੂਲ ਸਾਡੇ ਪਿੰਡ ਤੋਂ ਬਹੁਤ ਜ਼ਿਆਦਾ ਦੂਰ ਹੈ ਅਤੇ ਸਾਡੇ ਮਾਪੇ ਐਨੀ ਦੂਰ ਸਕੂਲ ਨਹੀਂ ਭੇਜਦੇ ਹੈ ਭੇਜਦੇ ਹਨ ਅਤੇ ਇਸ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਇਸ ਲਈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਬੱਚਿਆਂ ਨੂੰ ਹਰ ਸਹੂਲਤ ਪ੍ਰਾਪਤ ਹੋਵੇ ਅਤੇ ਇਸ ਲਈ ਮੈਂ ਹਮੇਸ਼ਾ ਕਸਬਿਆਂ ਦੇ ਵਿੱਚ ਨੇੜਲੇ ਪਿੰਡਾਂ ਵਿੱਚ ਦੌਰਾ ਕਰਦੀ ਰਹਿੰਦੀ ਹਾਂ